ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਲੈਕਟਰੋਨਿਕ ਦੀ ਸਾਡੇ ਜੀਵਨ ਵਿੱਚ ਕਿੰਨੀ ਮਹੱਤਤਾ ਹੈ ਅਤੇ ਇਹ ਰੋਜ਼ ਦੇ ਕੰਮਕਾਰ ਵਿੱਚ ਵਰਤੋਂ ਆਉਂਦਾ ਹੈ ਜਿੱਦਾਂ ਕਿ ਤੁਸੀਂ ਪੱਖਾ ਏ ਸੀ ਨੂੰ ਹੀ ਲੈ ਲਵੋ ਜਿੱਦਾਂ ਕਿ ਇਲੈਕਟਰੋਨਿਕਸ ਉਹ ਹੈ ਤਾਂ ਉਹ ਹੋਰ ਕੋਈ ਵੀ ਨਹੀਂ ਹੈ ਜਿੱਦਾਂ ਗਰਮੀਆਂ ਵਿੱਚ ਲੋਕ ਮਰਦੇ ਹਨ ਅਤੇ ਉਹ ਉਹ ਸਾਨੂੰ ਆਰਾਮ ਦਿੰਦਾ ਹੈ ਜਿਹਨਾਂ ਪੱਖਾ ਚਲਾ ਕੇ ਅਸੀਂ ਗਰਮੀ ਤੋਂ ਬਚ ਸਕਦੇ ਹਨ ਅਤੇ ਏ ਸੀ ਚਲਾ ਕੇ ਵੀ ਗਰਮੀ ਤੋਂ ਬਚ ਸਕਦੇ ਹਾਂ ਜਿੱਦਾਂ ਪੁਰਾਣੇ ਜਮਾਨੇ ਵਿੱਚ ਏ ਸੀ ਕੂਲਰ ਪੱਖੇ ਨਹੀਂ ਹੁੰਦੇ ਸੀ ਅਤੇ ਲੋਕ ਗਰਮੀ ਵਿੱਚ ਮਰ ਜਾਂਦੇ ਸੀ ਅਤੇ ਇਸ ਸਰਦੀ ਦਾ ਹੀ ਲੈ ਲਓ ਜਿੱਦਾਂ ਹੀਟਰ ਹੋ ਗਿਆ ਹੀਟਰ ਨਾਲ ਅਸੀਂ ਸਰਦੀ ਤੋਂ ਬਚ ਸਕਦੇ ਹਾਂ ਔਰ ਇਲੈਕਟਰਿਕ ਬਲੈਂਕਿਟ ਨਾਲ ਵੀ ਅਸੀਂ ਸਰਦੀ ਤੋਂ ਬਚ ਸਕਦੇ ਹਾਂ ਜਿਹੜਾ ਪਿਛਲੇ ਜਮਾਨੇ ਵਿੱਚ ਇਲੈਕਟ੍ਰਿਕ ਬਲੈਂਕਿਟ ਅਤੇ ਹੀਟਰ ਨਹੀਂ ਹੁੰਦੇ ਸੀ ਅਤੇ ਲੋਕ ਅੱਗ ਬਾਲ ਕੇ ਕੰਮ ਚਲਾਉਂਦੇ ਸੀ ਔਰ ਉਹਦੇ ਵਿੱਚ ਬਹੁਤ ਹੀ ਬ ਬਹੁਤ ਹੀ ਜ਼ਰੂਰਤ ਪੈਂਦੀ ਸੀ ਲੱਕੜੀਆਂ ਦੀ ਅਤੇ ਹੋਰ ਵੀ ਕਈ ਚੀਜ਼ਾਂ ਦੀ